ਮੇਰਾ ਮਨਪਸੰਦ ਸ਼ਬਦ ਸਤਿਨਾਮ ਵਾਹਿਗੁਰੂ ਹੈ ਜਦ ਵੀ ਮੈਂ ਕਿਸੇ ਦੁੱਖ ਤਕਲੀਫ਼ ਪੀੜਾ ਵਿੱਚ ਹੁੰਦਾ ਹਾਂ ਤਾਂ ਮੈਂ ਇਸ ਸ਼ਬਦ ਦਾ ਇਸਤੇਮਾਲ ਕਰਦਾ ਹਾਂ ਅਤੇ ਮੈਨੂੰ ਦੁਨੀਆ ਦਾ ਸੁੱਖ ਚੈਨ ਮਿਲ ਜਾਂਦਾ ਹੈ ਅਤੇ ਇੱਕ ਮੈਨੂੰ ਵਾਕ ਵੀ ਬੜਾ ਪਸੰਦ ਹੈ ਜੋ ਕਿ ਰੱਬ ਦੀ ਬੰਦਗੀ ਦੇ ਲਈ ਦਿੱਤਾ ਗਿਆ ਹੈ ਤੇਰਾ ਭਾਣਾ ਮੀਠਾ ਲਾਗੈ ਇਹਦਾ ਮਤਲਬ ਹੈ ਕਿ ਰੱਬ ਜੋ ਵੀ ਤੂੰ ਦੁੱਖ ਤਕਲੀਫ਼ ਦਿੱਤੀ ਹੈ ਬਸ ਉਸ ਰਜ਼ਾ ਦੇ ਵਿੱਚ ਰਾਜ਼ੀ ਹਾਂ ਅਸੀਂ ਸਾਨੂੰ ਕੋਈ ਚੱਕਰ ਨਹੀਂ ਬਸ ਤੇਰੀ ਰਜ਼ਾ ਦੇ ਵਿੱਚ ਰਾਜ਼ੀ ਹਾਂ ਅਸੀਂ ਅਤੇ ਮੈਨੂੰ ਪੰਜਾਬੀ ਹੋਣ ਦੇ ਉੱਤੇ ਬੜਾ ਮੈਂ ਮਾਣ ਮਹਿਸੂਸ ਕਰਦਾ ਹਾਂ ਸਾਡੀ ਇੱਕ ਵੱਖਰੀ ਪਹਿਚਾਣ ਆ ਜਿਹੜੀ ਵੀ ਲੋਕ ਦਸਤਾਰ ਸਜਾਉਂਦੇ ਨੇ ਇੱਕ ਵੱਖਰੀ ਪਹਿਚਾਣ ਲੋਕਾਂ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਦੀ ਹੈ ਜੋ ਵੀ ਪੰਜਾਬੀ ਹੈ ਜਿਹੜਾ ਦਸਤਾਰ ਸਿਰ ਦੇ ਉੱਤੇ ਸਾਜਦਾ ਹੈ